ਕਈ ਵਿਸ਼ੇ ਇੱਦਾਂ ਦੇ ਹੁੰਦੇ ਹਨ ਜਿਹਨਾਂ ਬਾਰੇ ਆਪਾਂ ਬੋਲਣਾ ਤਾਂ ਚਾਹੁੰਦੇ ਹਾਂ ਬਹੁਤ ਕੁਛ ਲਿਖਣਾ ਵੀ ਚਾਹੁੰਦੇ ਹਾਂ ਪਰ ਆਪਾਂ ਉਹ ਕਰ ਨਹੀਂ ਸਕਦੇ ਜਿਸ ਤਰ੍ਹਾਂ ਕਿ ਮੈਂ ਇੱਕ ਸਿੱਖ ਧਰਮ ਨਾਲ ਸੰਬੰਧਿਤ ਰੱਖਦੀ ਹਾਂ ਇਹ ਸਿੱਖ ਨਾਲ ਜੋ ਵੀ ਕਈ ਜਗ੍ਹਾ ਮੈਂ ਦੇਖਿਆ ਆਪਣੇ ਦੇਸ਼ ਵਿੱਚ ਲਾ ਲਓ ਹੁਣ ਤਾਂ ਪੰਜਾਬ ਵਿੱਚ ਵੀ ਹੋ ਜਾਂਦਾ ਬਹੁਤ ਵਿਤਕਰਾ ਹੁੰਦਾ ਹੈ ਜੋ ਮੈਨੂੰ ਮਹਿਸੂਸ ਹੁੰਦਾ ਕਿਉਂਕਿ ਸਾਡੇ ਸਿੱਖਾਂ ਨਾਲ ਬਹੁਤ ਵਿਤਕਰਾ ਹੁੰਦਾ ਹੈ ਔਰ ਇਸ ਬਾਰੇ ਮੈਂ ਬਹੁਤ ਕੁਛ ਬੋਲਣਾ ਵੀ ਚਾਹੁੰਦੀ ਹਾਂ ਜਿੱਦਾਂ ਕਿ ਚੁਰਾਸੀ ਵਿੱਚ ਵੀ ਹੋਇਆ ਸੀ ਅਤੇ ਆਪਣੇ ਅੰਮ੍ਰਿਤਸਰ 'ਤੇ ਜੋ ਵੀ ਅਟੈਕ ਹੋਏ ਇਸ ਬਾਰੇ ਬਹੁਤ ਖੁੱਲ੍ਹ ਕੇ ਅਤੇ ਇਸ ਦਾ ਵਿਰੋਧ ਵੀ ਬਹੁਤ ਪੁਰਜੋਰ ਮੈਂ ਕਰਨਾ ਚਾਹੁੰਦੀ ਹਾਂ ਪਰ ਮੈਂ ਕਰ ਨਹੀਂ ਸਕਦੀ ਕਿਉਂਕਿ ਸਰਕਾਰਾਂ ਇਸ ਚੀਜ਼ ਨੂੰ ਅਤੇ ਕਰਨ ਨਹੀਂ ਦਿੰਦੀਆਂ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀਆਂ ਸਾਨੂੰ ਕਿ ਆਪਾਂ ਇਸ ਦੇ ਖਿਲਾਫ਼ ਕੋਈ ਵੀ ਆਵਾਜ਼ ਉਠਾਈਏ ਜਦੋਂ ਵੀ ਕੋਈ ਆਵਾਜ਼ ਉਠਾਈ ਹੈ ਤਾਂ ਉਸ ਨੂੰ ਆਵਾਜ਼ ਨੂੰ ਦਬਾਇਆ ਗਿਆ ਹੈ ਅਤੇ ਜੋ ਕਿ ਮੈਨੂੰ ਅੰਦਰੋਂ ਅੰਦਰੀ ਖਾਂਦਾ ਵੀ ਹੈ ਅਤੇ ਬਹੁਤ ਮੇਰਾ ਮਨ ਵੀ ਦੁਖੀ ਹੁੰਦਾ ਅਤੇ ਹੋਰ ਵੀ ਮੇਰੇ ਵਰਗੇ ਕਈ ਲੋਕ ਨੇ ਜਿਹੜੇ ਇਸ ਚੀਜ਼ ਨੂੰ ਸਮਝਦੇ ਹਨ ਪਰ ਕਰ ਕੁਛ ਨਹੀਂ ਸਕਦੇ ਬੋਲਦੇ ਕੁਛ ਨਹੀਂ ਹੈ ਇਸ ਬਾਰੇ ਕਿਉਂਕਿ ਉਹ ਸਰਕਾਰਾਂ ਇਹ ਕਹਿੰਦੀਆਂ ਜੇ ਇਸ ਬਾਰੇ ਅਸੀਂ ਕੁਛ ਬੋਲਾਂਗੇ ਤਾਂ ਉਸ ਨੂੰ ਭੜਕਾਊ ਭਾਸ਼ਣ ਸਮਝਿਆ ਜਾਊਗਾ ਜਨਤਾ ਨੂੰ ਉਕਸਾਉਣ ਵਾਲੀਆਂ ਚੀਜ਼ਾਂ ਸਮਝ ਕੇ ਇਸ ਚੀਜ਼ ਨੂੰ ਦਬਾ ਦਿੱਤਾ ਜਾਂਦਾ ਹੈ ਔਰ ਇਹ ਚੀਜ਼ਾਂ ਮੇਰੀਆਂ ਮੇਰੇ ਅੰਦਰ ਹੀ ਦੱਬ ਕੇ ਰਹਿ ਜਾਦੀਆਂ ਹਨ